ਹੈਲੋ ਸਰ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਸਰ ਆਡਰ ਨੰਬਰ ਪੰਦਰਾਂ ਜਿਸਦੇ ਵਿੱਚ ਸ਼ਾਹੀ ਪਨੀਰ ਦਾਲ ਮੱਖਣੀ ਚਿਕਨ ਨਮਕੀਨ ਚੌਲ ਦਹੀਂ ਰੋਟੀਆਂ ਨਾਨ ਮਿੱਠੇ ਵਿੱਚ ਰਸਗੁੱਲੇ ਮੰਗਵਾਏ ਸੀ ਇਹ ਆਡਰ ਜਗਤਪੁਰ ਪਿੰਡ ਗਲੀ ਨੰਬਰ ਇੱਕ ਵਿੱਚ ਮੰਗਵਾਇਆ ਹੈ ਮੰਗਵਾਇਆ ਸੀ ਅਸੀਂ ਇਸ ਆਡਰ ਵਿੱਚ ਥੋੜ੍ਹਾ ਜਿਹਾ ਵਾਧਾ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੇ ਘਰ ਹੋਰ ਰਿਸ਼ਤੇਦਾਰ ਆ ਚੁੱਕੇ ਹਨ ਇਸ ਲਈ ਅਸੀਂ ਹੋਰ ਸਮਾਨ ਮੰਗਵਾਉਣਾ ਹੈ ਜਿਵੇਂ ਕਿ ਮਨਚੁਰੀਅਨ ਅਤੇ ਮਿੱਠੇ ਵਿੱਚ ਰਸ ਮਲਾਈ ਆਈਸਕ੍ਰੀਮ ਅਤੇ ਰੋਟੀਆਂ ਅਸੀਂ ਦੋ ਮੰਗਵਾਈਆਂ ਸਨ ਤਿੰਨ ਹੋਰ ਅਤੇ ਨਾਨ ਪੰਜ ਹੋਰ ਭੇਜ ਦਿਓ ਤੁਸੀਂ ਜਲਦੀ ਤੋਂ ਜਲਦੀ ਇਹ ਆਰਡਰ ਬੁੱਕ ਕਰਕੇ ਸਾਨੂੰ ਭੇਜ ਦਿਓ ਤਾਂ ਜੋ ਅਸੀਂ ਭੋਜਨ ਦਾ ਆਨੰਦ ਮਾਣ ਸਕੀਏ ਤੁਸੀਂ ਇਸ ਆਡਰ ਦੇ ਪੈਸੇ ਦੱਸ ਦਿਓ ਤਾਂ ਕਿ ਔਨਲਾਈਨ ਕਰਨਾ ਕਿ ਕੈਸ਼ ਦੇਣਾ ਹੈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ